ਮੈਨੂੰ ਵੱਖ ਵੱਖ ਥਾਵਾਂ 'ਤੇ ਘੁੰਮਣਾ ਬਹੁਤ ਪਸੰਦ ਹੈ ਪਿਛਲੇ ਸਾਲ ਮੈਂ ਆਪਣੇ ਪਰਿਵਾਰ ਦੇ ਨਾਲ ਪਤਨੀਟੋਪ ਜੋ ਕਿ ਜੰਮੂ ਕਸ਼ਮੀਰ ਵਿੱਚ ਹੈ ਉੱਥੇ ਗਈ ਉੱਥੇ ਅਸੀਂ ਦਸ ਜਣੇ ਸੀ ਅਤੇ ਸਭ ਨੂੰ ਜਾ ਕੇ ਉੱਥੇ ਬਹੁਤ ਹੀ ਆਨੰਦ ਆਇਆ ਜਿਹਦੇ ਵਿੱਚ ਬੱਚੇ ਵੀ ਸ਼ਾਮਿਲ ਸਨ ਅਸੀਂ ਸਭ ਤੋਂ ਪਹਿਲਾਂ ਆਪਣੀ ਹੀ ਕਾਰ ਵਿੱਚ ਗਏ ਅਤੇ ਉੱਥੋਂ ਦਾ ਦ੍ਰਿਸ਼ ਇੰਨਾਂ ਮਨਮੋਹਕ ਸੀ ਕਿ ਸਭ ਨੂੰ ਆਕਰਸ਼ਿਤ ਕਰ ਗਿਆ ਉੱਥੇ ਜਾ ਕੇ ਅਸੀਂ ਇੱਕ ਹੱਟ ਲਈ ਜਿੱਥੇ ਅਸੀਂ ਰਾਤ ਰਹੇ ਅਤੇ ਉੱਥੋਂ ਮੌਸਮ ਵੀ ਇੰਨਾਂ ਵਧੀਆ ਸੀ ਕਿ ਰਾਤ ਨੂੰ ਸਾਨੂੰ ਠੰਡ ਸਭ ਲੱਗਣੀ ਸ਼ੁਰੂ ਹੋ ਗਈ ਅਸੀਂ ਮੋਟੇ ਕੱਪੜੇ ਲੈ ਕੇ ਗਏ ਸੀ ਅਤੇ ਸਭ ਨੇ ਮੋਟੇ ਕੱਪੜੇ ਪਾ ਕੇ ਆਪਣੇ ਸਰੀਰ ਨੂੰ ਗਰਮ ਕੀਤਾ ਉਸ ਤੋਂ ਬਾਅਦ ਅਸੀਂ ਉੱਥੋਂ ਦੇ ਦ੍ਰਿਸ਼ ਬਹੁਤ ਹੀ ਜਗ੍ਹਾ ਘੁੰਮੇ ਅਤੇ ਜਿਹਦੇ ਨਾਲ ਅਸੀਂ ਇੰਨੇ ਆਕਰਸ਼ਿਤ ਹੋ ਗਏ ਮੈਂ ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਸੀ ਦੇਖਿਆ ਰਾਤ ਨੂੰ ਉੱਥੇ ਬਰਫ ਪੈਣੀ ਸ਼ੁਰੂ ਹੋ ਗਈ ਜਿਸ ਨੂੰ ਦੇਖ ਕੇ ਅਸੀਂ ਸਾਰੇ ਖੁਸ਼ ਹੋ ਗਏ ਅਤੇ ਅਸੀਂ ਰਾਤ ਨੂੰ ਬਾਹਰ ਬੈਠ ਕੇ ਅੱਗ ਲ ਅੱਗ ਜਲਾ ਕੇ ਸਭ ਨੇ ਸੇਕੀ ਅਤੇ ਸਾਰਿਆਂ ਨੇ ਰਾਤ ਤੱਕ ਬੈਠ ਕੇ ਗੱਲਾਂ ਮਾਰਦੇ ਰਹੇ ਮੈਨੂੰ ਉਹ ਜਗ੍ਹਾ ਬਹੁਤ ਹੀ ਪਸੰਦ ਆਈ ਉੱਥੋਂ ਦੇ ਉੱਚੇ ਉੱਚੇ ਪਹਾੜ ਅਤੇ ਉੱਥੋਂ ਦੀ ਹਵਾ ਉੱਥੋਂ ਦਾ ਮਾਹੌਲ ਬਹੁਤ ਹੀ ਵਧੀਆ ਸੀ ਇਸ ਤਰ੍ਹਾਂ ਦਾ ਵਾਤਾਵਰਨ ਸਿਰਫ ਪਹਾੜੀ ਇਲਾਕੇ ਵਿੱਚ ਹੀ ਮਿਲ ਸਕਦਾ ਹੈ ਮੈਨੂੰ ਉੱਥੇ ਜਾ ਕੇ ਬਹੁਤ ਮਜ਼ਾ ਆਇਆ ਅਤੇ ਬਹੁਤ ਹੀ ਆਨੰਦ ਲਿਆ